ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ਪਹਿਲੇ ਸਮੇਂ ਦੇ ਵਿੱਚ ਸਾਡੇ ਆਪਾਂ ਇੱਕ ਦੂਜੇ ਨੂੰ ਕ੍ਰਿੰਤੂ ਪ੍ਰੰਤੂ ਸਮਝਦੇ ਸਨ ਅਤੇ ਹੁਣ ਇਸ ਟਾਇਮ ਗੁਰੂ ਦੇ ਨਾਲ ਜੁੜ ਜੁੜਨ ਦੇ ਅਨੁਸਾਰ ਜੋ ਕਿ ਸਾਨੂੰ ਸਿੱਖਿਆ ਮਿਲਦੀ ਹਨ ਕਿ ਆਪਣੇ ਇਸਤਰੀ ਅਤੇ ਆਪਣੇ ਭੈਣ ਭਾਈਆਂ ਅਤੇ ਹੋਰ ਸਾਰੇ ਪਰਿਵਾਰ ਨੂੰ ਇੱਕ ਜਿਹਾ ਸਮਝੀਏ ਗੁਰੂ ਨਾਨਕ ਦੇਵ ਜੀ ਨੇ ਵੀ ਆਖਿਆ ਮੈਨੂੰ ਇੱਕ ਨਜ਼ਰ ਦੇ ਵਿੱਚ ਸਾਰੇ ਦਿਖਦੇ ਹਨ ਏਕ ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ